ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਠੀਕ ਹੈ ਮੈਮ ਠੀਕ ਹੈ ਮੈਮ ਬੱਚੇ ਦੀ ਪ੍ਰਫੋਰਮੈਂਸ ਲਗਭਗ ਤਾਂ ਜੀ ਦੇਖੋ ਥੋੜ੍ਹਾ ਜਿਹਾ ਮੈਨੂੰ ਲੱਗਦਾ ਵਾ ਨਾ ਆਪਣੇ ਸਾਹਿਬਨੂਰ ਜੋ ਤੁਹਾਡਾ ਬੱਚਾ ਥੋੜ੍ਹਾ ਜਿਹਾ ਵੀਕ ਹੈ ਜੀ ਐਕਟੀਵਿਟੀ ਦੇ ਵਿੱਚ ਕਹਿ ਲਉ ਹੈ ਨਾ ਮਿਊਜਿਕ ਦੇ ਵਿੱਚ ਜਾਂ ਹੈ ਨਾ ਡਾਂਸ ਦੇ ਵਿੱਚ ਪਾਰਟੀਸੀਪੇਟ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਹਾਂਜੀ ਬਾਕੀ ਨਾ ਮੈਂ ਤੁਹਾਨੂੰ ਐਂ ਕਹਿਣਾ ਸੀਗਾ ਵੀ ਤੁਸੀਂ ਨਾ ਕਿਸੇ ਡਾਕਟਰ ਨਾਲ ਕੰਸਲਟ ਕਰੋ ਵੀ ਮੈਨੂੰ ਲੱਗਦਾ ਵੀ ਤੁਹਾਡੇ ਨਾ ਬੱਚੇ ਦੀ ਵੋਕਲ 'ਚ ਥੋੜ੍ਹੀ ਦਿੱਕਤ ਹੈਗੀ ਹੈ ਕੋਈ ਕਿਉਂਕਿ ਬਾਕੀ ਬੱਚਿਆਂ ਵਾਂਗੂ ਇਹ ਬੱਚੇ ਦਾ ਨਾ ਆਪਣੇ ਦੀ ਜਿਹੜੀ ਵੋਕਲ ਹੈ ਮੈਨੂੰ ਐਂ ਲੱਗਦਾ ਕਮਜ਼ੋਰ ਹੈ ਕੋਈ ਇਹਨੂੰ ਬੋਲਣ 'ਚ ਦਿੱਕਤ ਬਹੁਤ ਆਉਂਦੀ ਹੈ ਹੂੰ ਵੈਸੇ ਤੁਸੀਂ ਕੀਤਾ ਕਿਸੇ ਡੋਕ ਡੋਕਟਰ ਨਾਲ ਕੰਸਲਟ ਕੀਤਾ ਹੋਇਆ ਤੁਸੀਂ ਕਿਸੇ ਨਾਲ ਵੈਸੇ ਇਸ ਚੀਜ਼ ਬਾਰੇ ਓਕੇ ਓਕੇ ਨਹੀਂ ਮਿਊਜਿਕ ਦੇ ਵਿੱਚ ਪ੍ਰਫੋਰਮੈਂਸ ਥੋੜ੍ਹੀ ਥੋੜ੍ਹੀ ਨਹੀਂ ਕਹਿ ਲਉ ਬਹੁਤ ਜ਼ਿਆਦਾ ਵੀਕ ਹੈ ਬੱਚੇ ਦੀ ਤੁਹਾਨੂੰ ਮੈਂ ਦੱਸੀ ਦਿੱਕਤ ਹੈ ਨਾ ਬੋਲਣ ਦੇ ਵਿੱਚ ਬੱਚੇ ਨੂੰ ਬਹੁਤ ਆਉਂਦੀ ਹੈ ਬਾਕੀ ਉੱਦਾਂ ਓਵਰਆਲ ਵੇਖਿਆ ਜਾਵੇ ਤਾਂ ਇਹ ਸਟੱਡੀ ਸਟੱਡੀ 'ਚ ਬਹੁਤ ਵਧੀਆ ਜੀ ਬੱਚਾ ਸਟੱਡੀ 'ਚ ਏ ਵਨ ਹੈ ਹਾਂਜੀ ਹਾਂਜੀ ਐਂਡ ਵੀ ਗਰਾਊਂਡ ਦੇ ਵਿੱਚ ਨਹੀਂ ਜੀ ਫਿਜੀਕਲੀ ਥੋੜ੍ਹੀ ਇਹ ਮਤਲਬ ਵੀ ਨਾ ਫਿਜੀਕਲੀ ਵੀ ਨਹੀਂ ਐਨੀ ਫਿੱਟ ਹੈਗੀ ਬੱਚੀ ਨਾ ਥੋੜ੍ਹੀ ਘਬਰਾਉਂਦੀ ਆ ਹਰ ਇੱਕ ਚੀਜ਼ ਨੂੰ ਵੇਖ ਕੇ ਗਰੋਂਡ 'ਚ ਜਾਣ ਲੱਗੇ ਨੂੰ ਘਬਰਾਉਣਾ ਵੀ ਕਿਤੇ ਡਿੱਗ ਨਾ ਪਵੇ ਜਾਂ ਕੁਛ ਵੀ ਏਦਾਂ ਦੀ ਬੱਚੇ ਦੇ ਮਨ ਦੇ ਵਿੱਚ ਹੁਣ ਤੋਂ ਹੀ ਗੱਲਾਂ ਆਉਣੀਆਂ ਹੈ ਨਾ ਵੀ ਵੀਕ ਬਣਾ ਦਿੰਦੀਆਂ ਉਹਨੂੰ ਹਾਂਜੀ ਬਾਕੀ ਸਟੱਡੀ ਸਟੱਡੀ ਹੋ ਗਈ ਓਵਰਆਲ ਬਹੁਤ ਵਧੀਆ ਬੱਚਾ ਆਪਣਾ ਕਲਾਸ ਦੇ ਵਿੱਚ ਬਹੁਤ ਵਧੀਆ ਬਿਹੇਵ ਕਰਦਾ ਵਾ ਮੈਨਰਸ ਹੈਗੀਆਂ ਨੇ ਪਰ ਥੋੜ੍ਹਾ ਨਾ ਫਿਜੀਕਲੀ ਵੀਕ ਹੈ ਬੱਚਾ ਜੀ ਮਿਊਜਿਕ ਦੇ ਵਿੱਚ ਐਕਟੀਵਿਟੀ ਦੇ ਵਿੱਚ ਬੱਚਾ ਪਾਟੀਸੀਪੇਟ ਨਹੀਂ ਕਰਦਾ ਕਿਉਂਕਿ ਉਨ੍ਹਾਂ ਨੂੰ ਐਂ ਵੀ ਝਿਜਕ ਹੋ ਗਈ ਇੱਕ ਸ਼ਾਈਨੈੱਸ ਬਹੁਤ ਜ਼ਿਆਦਾ ਬੱਚੇ ਦੇ ਵਿੱਚ ਤੁਸੀਂ ਨਾ ਬੱਚੇ ਨੂੰ ਲੈ ਕੇ ਜਾਇਆ ਕਰੋ ਬਾਹਰ ਅੰਦਰ ਨਿਕਲਦਾ ਬੱਚਾ ਸੰਗ ਖੁੱਲ੍ਹਦੀ ਹੈ ਹਾਂਜੀ ਅਤੇ ਓਕੇ ਓਕੇ ਓਕੇ